ਪੰਜਾਬੀ ਸੱਭਿਆਚਾਰ ਦੇ ਵਿੱਚ ਭੰਗੜੇ ਦੀ ਬਹੁਤ ਜ਼ਿਆਦਾ ਮਹੱਤਤਾ ਹੈ ਸਮੇਂ ਦੇ ਨਾਲ ਨਾਲ ਪੰਜਾਬ ਦੇ ਹਰੇਕ ਤਿਉਹਾਰ 'ਤੇ ਹੀ ਭੰਗੜੇ ਨੂੰ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾਂਦਾ ਹੈ ਭੰਗੜਾ ਇੱਕ ਹਰੇਕ ਤਿਉਹਾਰ ਦਾ ਹਰੇਕ ਮੇਲੇ ਦਾ ਇੱਕ ਮੇਨ ਰੋਲ ਬਣ ਚੁੱਕਿਆ ਹੈ ਬਹੁਤ ਸਾਰੇ ਸਾਡੇ ਪੰਜਾਬ ਦੇ ਵਿੱਚ ਮੇਲੇ ਲੱਗਦੇ ਹਨ ਜਿਵੇਂ ਛਪਾਰ ਦਾ ਮੇਲਾ ਮਾਘੀ ਦਾ ਮੇਲਾ ਮੇਲਿਆਂ ਦੇ ਵਿੱਚ ਭੰਗੜਾ ਇੱਕ ਮੇਨ ਰੱਖਿਆ ਜਾਂਦਾ ਹੈ ਭੰਗੜਾ ਨੌਜਵਾਨ ਪੀੜ੍ਹੀ ਸਾਡੀ ਜਦੋਂ ਭੰਗੜਿਆਂ ਦੇ ਵਿੱਚ ਜਾਂਦੀ ਹੈ ਤਾਂ ਆਪਣੇ ਸਰੀਰ ਨੂੰ ਫਿੱਟ ਰੱਖਦੀ ਹੈ ਅਤੇ ਗੱਭਰੂ ਪੂਰੇ ਹੋਸ਼ ਜੋਸ਼ ਦੇ ਨਾਲ ਜਦੋਂ ਭੰਗੜੇ ਪਾਉਂਦੇ ਹਨ ਤਾਂ ਲੋਕਾਂ ਦੇ ਬਹੁਤ ਹੀ ਜ਼ਿਆਦਾ ਵਧੀਆ ਮਨੋਰੰਜਨ ਹੁੰਦਾ ਹੈ ਲੋਕਾਂ ਦਾ ਦਿਲ ਖੁਸ਼ ਹੁੰਦਾ ਹੈ ਬਹੁਤ ਸਾਰੇ ਲੋਕ ਇੱਦਾਂ ਦੇ ਜਿਹੜੇ ਬਾਹਰੋਂ ਆਉਂਦੇ ਹਨ ਮੇਲਾ ਦੇਖਣ ਵਾਸਤੇ ਹੋਰ ਸਟੇਟਾਂ ਤੋਂ ਉਹ ਮੇਨ ਜ਼ਿਆਦਾ ਸਾਡੇ ਭੰਗੜੇ ਦਾ ਫੰਕਸ਼ਨ ਹੀ ਵੇਖਣ ਆਉਂਦੇ ਹਨ ਸਾਡਾ ਭੰਗੜਾ ਹੀ ਵੇਖਣ ਆਉਂਦੇ ਹਨ ਭੰਗੜੇ ਵਾਲੇ ਮੁੰਡਿਆ ਗੱਭਰੂਆਂ ਦੀਆਂ ਡਰੈਸਾਂ ਇੱਕ ਇਸ ਤਰ੍ਹਾਂ ਦੀਆਂ ਪਾਈਆਂ ਹੁੰਦੀਆਂ ਹਨ ਜੋ ਕਿ ਬੜੀਆਂ ਹੀ ਲਚਕੀਲੀਆਂ ਅਤੇ ਬੜੀਆਂ ਹੀ ਚਮਕਦਾਰ ਅਤੇ ਬੜੀਆਂ ਹੀ ਸੋਹਣੀਆਂ ਹੁੰਦੀਆਂ ਹਨ ਜਿਹਨਾਂ ਨੂੰ ਦੇਖ ਕੇ ਬੜਾ ਹੀ ਦਿਲ ਖੁਸ਼ ਹੁੰਦਾ ਹੈ ਭੰਗੜਾ ਸਾਡੇ ਤਿਉਹਾਰਾਂ ਦਾ ਇੱਕ ਮੇਨ ਰੋਲ ਬਣ ਚੁੱਕਿਆ ਹੈ ਜਿਹਦੇ ਵਿੱਚ ਜਾ ਕੇ ਸਾਡੇ ਜਦੋਂ ਪੰਜਾਬ ਦੇ ਗੱਭਰੂ ਭੰਗੜਾ ਪਾਉਂਦੇ ਹਨ ਤਾਂ ਸਾਡੇ ਦਰਕਸ਼ਾਂ ਦੇ ਲੋਕਾਂ ਦਾ ਮਨ ਬੜਾ ਹੀ ਰਚੇਵਾਂ ਭਰ ਜਾਂਦਾ ਹੈ ਇੱਥੋਂ ਤੱਕ ਕਿ ਜਦੋਂ ਉਹ ਭੰਗੜਾ ਪਾਉਂਦੇ ਹਨ ਤਾਂ ਥੱਲੇ ਖੜ੍ਹੇ ਸਾਰੇ ਹੀ ਲੋਕ ਉਹਨਾਂ ਦੇ ਨਾਲ ਝੂਮ ਉੱਠਦੇ ਹਨ ਅਤੇ ਨਾਲ ਭੰਗੜਾ ਪਾਉਣਾ ਸ਼ੁਰੂ ਕਰਦੇ ਕਰ ਦਿੰਦੇ ਹਨ ਭੰਗੜੇ ਦੇ ਬਹੁਤ ਹੀ ਵਧੀਆ ਵਧੀਆ ਸਟੈਪ ਹੁੰਦੇ ਹਨ ਜੋ ਕਿ ਬੱਚੇ ਸਾਡੇ ਕੋਚਿੰਗ ਲੈ ਕੇ ਸਿੱਖ ਕੇ ਅਤੇ ਪੰਜਾਬ ਦਾ ਨਾਮ ਰੋਸ਼ਨ ਕਰਦੇ ਹਨ ਅਤੇ ਪੂਰਾ ਲੋਕਾਂ ਦਾ ਮਨੋਰੰਜਨ ਕਰਦੇ ਹਨ